ਟਰੈਕ ਉੱਤੇ ਜਾਣਾ ਮੇਰਾ ਸ਼ੌਂਕ ਹੈ ਮੈਂ ਆਪਣੀ ਨਿੱਜੀ ਅਤੇ ਪੇਸ਼ਾਵਰ ਜ਼ਿੰਦਗੀ ਦਾ ਪ੍ਰਬੰਧ ਟਰੈਕ 'ਤੇ ਜਾਣ ਸਮੇਂ ਬਹੁਤ ਹੀ ਵਧੀਆ ਢੰਗ ਨਾਲ ਕਰਦਾ ਹਾਂ ਮੈਨੂੰ ਟਰੈਕ 'ਤੇ ਜਾਣਾ ਇਸ ਲੀਏ ਵੀ ਵਧੀਆ ਲੱਗਦਾ ਹੈ ਕਿਉਂਕਿ ਯਾਤਰਾ ਦੌਰਾਨ ਨਵੇਂ ਤਜਰਬੇ ਮੇਰੇ ਪੇਸ਼ਾਵਰ ਅਤੇ ਨਿੱਜੀ ਵਿਕਾਸ ਵਿੱਚ ਮਦਦ ਕਰਦੇ ਹਨ ਇਸ ਨਾਲ ਮੇਰੇ ਕੰਮਕਾਜੀ ਕੁਸ਼ਲਤਾ ਵੀ ਵਧਦੀ ਹੈ ਯਾਤਰਾ ਦੌਰਾਨ ਮੈਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹਿੰਦਾ ਹਾਂ ਅਤੇ ਆਪਣੇ ਕੰਮ ਨੂੰ ਵੀ ਕਦੇ ਕਦੇ ਰਿਮੋਟ ਵਰਕ ਨਾਲ ਪੂਰਾ ਕਰਦਾ ਹਾਂ ਮੈਂ ਯਾਤਰਾ ਦਾ ਵੀ ਆਨੰਦ ਮਾਣਦਾ ਹਾਂ ਯਾਤਰਾ ਦੇ ਨਾਲ ਮੈਨੂੰ ਆਪਣੀ ਸਿਹਤ ਦੇ ਵਿੱਚ ਵੀ ਤੰਦਰੁਸਤੀ ਮਿਲਦੀ ਹੈ ਜਿਸ ਨਾਲ ਮੈਨੂੰ ਕੰਮ ਵਿੱਚ ਹੋਰ ਵੀ ਵਧੀਆ ਢੰਗ ਨਾਲ ਕਰਨ ਦੀ ਕੁਸ਼ਲਤਾ ਮਿਲਦੀ ਹੈ ਯਾਤਰਾ ਦੇ ਦੌਰਾਨ ਮੇਰਾ ਪਰਿਵਾਰ ਅਤੇ ਦੋਸਤ ਵੀ ਮੇਰਾ ਸਮਰਥਨ ਕਰਦੇ ਹਨ ਇੱਕ ਵਾਰ ਮੈਂ ਯਾਤਰਾ ਦੌਰਾਨ ਬਹੁਤ ਸਾਰੀਆਂ ਫੋਟੋਆਂ ਖਿੱਚ ਕੇ ਲੈ ਕੇ ਆਇਆ ਸੀ ਇੱਕ ਵਾਰੀ ਇੱਕ ਪ੍ਰਤੀਯੋਗਤਾ ਦੇ ਵਿੱਚ ਮੈਂ ਆਪਣੀ ਫੋਟੋਆਂ ਦਾ ਇਸਤੇਮਾਲ ਕੀਤਾ ਸੀ ਜਿਸ ਨਾਲ ਇੱਕ ਪਬਲਿਸ਼ੀਅਰ ਨੇ ਮੇਰੀ ਫੋਟੋ ਨੂੰ ਆਪਣੇ ਕਲੰਡਰ ਦੇ ਫਰੰਟ ਪੇਜ ਦੇ ਲੀਏ ਸਿਲੈਕਟ ਕੀਤਾ ਸੀ ਜਿਸ ਨਾਲ ਮੇਰੇ ਪਰਿਵਾਰ ਅਤੇ ਮੇਰੇ ਦੋਸਤਾਂ ਸਾਹਮਣੇ ਮੇਰੀ ਵਡਿਆਈ ਹੋਈ ਸੀ ਇਸ ਕਾਰਨ ਮੈਨੂੰ ਯਾਤਰਾ ਦਾ ਅਨੰਦ ਵੀ ਮਾਨਣ ਦਾ ਮੌਕਾ ਮਿਲਦਾ ਹੈ